ਇਹ ਤਾਂ ਆਪਾਂ ਡੇਲੀ ਦੇਖ ਸਕਦੇ ਹੈਗੇ ਹੈ ਆਪਾਂ ਜਦੋਂ ਵੀ ਅਖਬਾਰ ਚੱਕਦੇ ਹਾਂ ਉਹਦੇ 'ਚੋਂ ਇੱਕ ਤੋਂ ਦੋ ਕਿਸਾਨਾਂ ਦੀ ਸਾਨੂੰ ਮਿਲਦਾ ਹੀ ਹੈਗਾ ਜਨਰਲੀ ਵੀ ਅੱਜ ਇੱਥੇ ਕਿਸਾਨ ਨੇ ਖੁਦਕੁਸ਼ੀ ਕੀਤੀ ਹੈਗੀ ਇੱਥੇ ਆਤਮ ਹੱਤਿਆ ਕਰ ਲਈ ਹੈਗੀ ਹੈ ਉਹਦੇ ਬਾਰੇ ਮੇਰਾ ਤਾਂ ਇਹੀ ਵਿਚਾਰ ਹੈਗਾ ਹੈ ਵੀ ਕਿਸਾਨ ਖੁਦਕੁਸ਼ੀ ਕਿਉਂ ਕਰਦਾ ਹੈਗਾ ਹੈ ਕਿਸਾਨ ਦਾ ਖੁਦਕੁਸ਼ੀ ਕਰਨ ਦਾ ਇੱਕ ਤਾਂ ਸਾਰਿਆਂ ਨਾਲੋਂ ਜਿਹੜਾ ਮੇਨ ਕਾਰਨ ਹੈਗਾ ਉਹਨੂੰ ਕਸ ਉਹਨੂੰ ਫਸਲ ਦਾ ਉੱਚਿਤ ਮੁੱਲ ਨਹੀਂ ਮਿਲਦਾ ਹੈਗਾ ਹੈ ਸਰਕਾਰ ਨੂੰ ਮੰਡੀਆਂ 'ਚ ਮਤਲਬ ਵਧੀਆ ਤੋਂ ਵਧੀਆ ਜਿਹੜੇ ਗੱਭੇ ਦੇ ਮੀਡੀਏਟਰ ਹੈਗਾ ਹੈ ਉਹਨਾਂ ਨੂੰ ਹਟਾ ਕੇ ਸਿੱਧਾ ਕਿਸਾਨਾਂ ਨਾਲ ਸੰਪਰਕ ਕਰਨਾ ਚਾਹੀਦਾ ਹੈਗਾ ਤਾਂ ਜਿਹੜੇ ਮੀਡੀਏਟਰ ਨੂੰ ਪੈਸੇ ਜਾਂਦੇ ਹੈਗੇ ਉਹ ਵੀ ਕਿਸਾਨ ਨੂੰ ਆਉਣ ਤਾਂ ਜੋ ਅੱਗੇ ਤੋਂ ਅੱਗੇ ਜਿਹੜੇ ਸਾਡੀ ਦੇਸ਼ ਦੀ ਇਕਨੋਮੀ ਵਿੱਚ ਅਤੇ ਆਪਣੇ ਜੋ ਵੀ ਨਵੇਂ ਤੋਂ ਨਵੇਂ ਔਰਗੈਨਿਕ ਢੰਗਾਂ ਨਾਲ ਖੇਤੀ ਕਰਕੇ ਇੱਕ ਦੇਸ਼ ਨੂੰ ਮਤਲਬ ਹੋਰ ਅੱਗੇ ਲੈ ਅਤੇ ਉਹਨਾਂ ਨੂੰ ਸਿਹਤ ਪੱਖੋਂ ਵੀ ਵਧੀਆ ਰਹੇ ਦੇਸ਼ ਵੀ ਅਤੇ ਕਿਸਾਨ ਵੀ